ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਆਈਆਂ ਜਿਵੇਂ ਕਿ ਬੀ ਜੇ ਪੀ ਦਾ ਵੀ ਰਾਜ ਆਇਆ ਅਤੇ ਉਹਦਾ ਕਾਂਗਰਸ ਦਾ ਵੀ ਆਇਆ ਅਕਾਲੀ ਦਲ ਦਾ ਵੀ ਆਇਆ ਅਲੱਗ ਅਲੱਗ ਸਿਆਸੀਆਂ ਪਾਰਟੀਆਂ ਅਲੱਗ ਅਲੱਗ ਟਾਈਮ 'ਤੇ ਆਉਂਦੀਆਂ ਰਹੀਆਂ ਹੁਣ ਜਿਵੇਂ ਕਿ ਆਮ ਆਦਮੀ ਪਾਰਟੀ ਆਈ ਹੈ ਪੰਜਾਬ ਦੇ ਵਿੱਚ ਅਤੇ ਉਹਦਾ ਬਹੁਤ ਹੀ ਵਧੀਆ ਪ੍ਰਭਾਵ ਪਿਆ ਹੈ ਪੂਰੇ ਪੰਜਾਬ ਦੇ ਉੱਤੇ ਉਹਦਾ ਮੁੱਖ ਬਲਿਦਾਨ ਹੈਗਾ ਹੈ ਮੁੱਖ ਮਤਲਬ ਕੰਮ ਜਿਹੜਾ ਉਹਨੇ ਕੀਤਾ ਹੈਗਾ ਹੈ ਉਹ ਕੀਤਾ ਬਿਜਲੀ ਬਿਜਲੀ ਦਾ ਉਹਨੇ ਤਿੰਨ ਸੌ ਯੂਨਿਟਾਂ ਪੂਰੇ ਪੰਜਾਬ ਦੇ ਵਿੱਚ ਫਰੀ ਕਰਤੀ ਤਿੰਨ ਸੌ ਯੂਨਿਟ ਤੱਕ ਆਮ ਆਦਮੀ ਦੇ ਤਿੰਨ ਸੌ ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਨਹੀਂ ਹੁੰਦੀ ਅਤੇ ਇਸ ਦਾ ਸਿੱਧਾ ਫ਼ਾਇਦਾ ਜਿਹੜਾ ਹੈਗਾ ਉਹ ਆਮ ਆਦਮੀ ਦੇ ਵਰਗ ਨੂੰ ਮਿਲਿਆ ਹੈਗਾ ਅਤੇ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦਾ ਇਹ ਸਭ ਤੋਂ ਵੱਡਾ ਮੈਨੂੰ ਕੰਮ ਲੱਗਦਾ ਹੈ ਕਿ ਉਹ ਉਸਨੇ ਇੱਕ ਨੀਵੇਂ ਪਰਿਵਾਰ ਦੀ ਜਾਂ ਆਮ ਆਦਮੀ ਦੀ ਬਹੁਤ ਹੀ ਮਦਦ ਕੀਤੀ ਹੈ ਇਸ ਕੰਮ ਨੂੰ ਕਰਕੇ